ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੋਹਾਲੀ ਤੋਂ ਬੋਲਦੇ ਜੀ ਮੈਨੂੰ ਨਾ ਜੀ ਮੈਂ ਤੁਹਾਡੇ ਆਪਣਾ ਕਿਸੇ ਤੋਂ ਨੰਬਰ ਲਿਆ ਤਾ ਮੈਨੂੰ ਤੁਹਾਡਾ ਨੰਬਰ ਦਿੱਤਾ ਉਹਨੇ ਮੈਂ ਮੋਹਾਲੀ 'ਚ ਰੈਸਟਰੋਰੈਂਟ ਵਧੀਆ ਜਿਹੇ ਰੈਸਟਰੋਰੈਂਟ ਬਾਰੇ ਮੈਂ ਜਾਣਕਾਰੀ ਲੈਣਾ ਚਾਹੁੰਦਾ ਜੀ ਹਾਂਜੀ ਅਤੇ ਸਾਨੂੰ ਬਸ ਫਾਸਟ ਸਰਵਿਸ ਹੋਵੇ ਵਧੀਆ ਹੋਵੇ ਚੱਕਰ ਨਹੀਂ ਪੈਸੇ ਵਾਲੀ ਕੋਈ ਚੱਕਰ ਨਹੀਂ ਵਧੀਆ ਸਰਵਿਸ ਹੋਵੇ ਸਾਫ਼ ਸਫ਼ਾਈ ਵਾਲਾ ਕੰਮ ਹੋਵੇ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਨੂੰ ਵੈਜ ਚਾਹੀਦਾ ਜੀ ਹਾਂਜੀ ਅੱਛਾ ਜੀ ਇਹਦੇ ਸਰਵਿਸ ਫਾਸਟ ਹੈ ਜੀ ਬਾਕੀ ਵਧੀਆ ਫੂਡ ਫਾਡ ਐਨ ਓਕੇ ਹੈ ਸਾਫ਼ ਹੈ ਜੀ ਬਸ ਠ ਠੀਕ ਹੈ ਜੀ ਧੰਨਵਾਦ ਓਕ